ਹਾਂਜੀ ਮੈਨੂੰ ਪੰਜਾਬੀ ਤੋਂ ਇਲਾਵਾ ਦੂਜੀਆਂ ਭਾਸ਼ਾ ਦਾ ਭਾਸ਼ਾਵਾਂ ਦਾ ਅਨੁਵਾਦ ਕਰਨਾ ਪੈਂਦਾ ਸਮੇਂ ਸਮੇਂ 'ਤੇ ਪੈਂਦਾ ਹੈ ਅਤੇ ਮੈਂ ਕਾਫੀ ਵਾਰੀ ਇਹ ਕੀਤਾ ਵੀ ਹੈ ਕਿਉਂਕਿ ਹਮੇਸ਼ਾ ਹੀ ਜਦੋਂ ਮੈਂ ਘਰ ਤੋਂ ਬਾਹਰ ਜਾਂਦਾ ਹਾਂ ਤਾਂ ਮੈਨੂੰ ਪੰਜਾਬੀ ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾਵਾਂ ਬੋਲਣ ਵਾਲੇ ਲੋਕ ਮਿਲਦੇ ਹਨ ਅਤੇ ਉਹਨਾਂ ਨਾਲ ਗੱਲ ਕਰਨ ਲੱਗੇ ਮੈਨੂੰ ਉਹਨਾਂ ਦੀ ਲੈਂਗੁਏਜ਼ ਤੋਂ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨਾ ਪੈਂਦਾ ਏ ਬਟ ਇਹ ਮੇਰੇ ਲਈ ਕੋਈ ਜ਼ਿਆਦਾ ਵੱਡੀ ਗੱਲ ਹੈ ਨਹੀਂ ਮੈਂ ਆਸਾਨੀ ਨਾਲ ਹੀ ਹਿੰਦੀ ਤੋਂ ਪੰਜਾਬੀ ਪੰਜਾਬੀ ਤੋਂ ਹਿੰਦੀ ਦੋਵੇਂ ਤਰ੍ਹਾਂ ਦੇ ਅਨੁਵਾਦ ਕਰ ਸਕਦਾ ਹਾਂ ਮੈਨੂੰ ਗੱਲ ਕਰਨ 'ਚ ਕੋਈ ਪਰੇਸ਼ਾਨੀ ਮੁਸ਼ਕਿਲ ਨਹੀਂ ਆਉਂਦੀ ਜੋ ਮੇਰਾ ਇਹ ਅਨੁਵਾਦ ਕਰਨ ਦਾ ਐਕਸਪੀਰੀਅੰਸ ਹੈ ਉਹ ਬਹੁਤ ਵਧੀਆ ਹੈ